ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਹਾਂਜੀ ਹਾਂਜੀ ਹਾਂਜੀ

ਹਾਂਜੀ ਪੰਜਾਬ ਦੇ ਵਿੱਚ ਤਾਂ ਆਪਣੀ ਇੱਕ ਪੰਜਾਬ ਯੂਨੀਵਰਸਿਟੀ ਹੋ ਗਈ ਪੰਜਾਬੀ ਯੂਨੀਵਰਸਿਟੀ ਹੋ ਗਈ ਅਤੇ ਆਪਣੀ ਇੱਕ ਚੰਡੀਗੜ੍ਹ ਯੂਨੀਵਰਸਿਟੀ ਹੋ ਗਈ ਰਿਆਤ ਬਾਹਰਾ ਯੂਨੀਵਰਸਿਟੀ ਵੀ ਅੱਛੀ ਆ ਤੁਸੀਂ ਕਿਹੜੇ ਕੋਰਸ ਬਾਰੇ ਸੋਚ ਰਹੇ ਹੋ ਕੀ ਕੋਰਸ ਲੈਣਾ ਚਾਹੋਂਗੇ ਬੀ ਟੈੱਕ ਦੇ ਲਈ ਤਾਂ ਤੁਸੀਂ ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਵੀ ਦੇਖ ਸਕਦੇ ਹੋ ਐਡਮਿਸ਼ਨਸ ਲੈ ਸਕਦੇ ਹੋ ਰਿਆਤ ਬਹਾਰਾ ਯੂਨੀਵਰਸਿਟੀ ਦੀ ਫੈਸਿਲਿਟੀਜ਼ ਅੱਛੀ ਆ ਲੈਬ ਬਹੁਤ ਅੱਛੀ ਆ ਅਤੇ ਪ੍ਰੋਫੈਸਰਸ ਵੀ ਸਟਾਫ ਵੀ ਪੂਰਾ ਕੰਪਲੀਟ ਹੈ ਉਨ੍ਹਾਂ ਦਾ ਮਤਲਬ ਵਧੀਆ ਆ ਸਟੱਡੀ ਜੋ ਕਰਾਉਂਦੇ ਆ ਸਭ ਕੁਛ ਵਧੀਆ ਆ ਹਾਂਜੀ ਫੀਸ ਸਟੱਕਚਰ ਵੀ ਸਭ ਦਾ ਅਲੱਗ ਅਲੱਗ ਹੈ ਰਿਆਤ ਬਾਹਰਾ ਯੂਨੀਵਰਸਿਟੀ ਦਾ ਫੀਸ ਸਟੱਕਚਰ ਅੱਛਾ ਆ ਰੀਜਨਏਬਲ ਹੈ ਹਾਂਜੀ ਹਾਂਜੀ ਹਾਂਜੀ ਸਭ ਕੁਛ ਉਹਦਾ ਵਧੀਆ ਪਲੇਸੈਂਸੀ ਵੀ ਅੱਛੀਆਂ ਆ ਦਿੰਦੇ ਹੈ ਅਤੇ ਜੋ ਉਹਦਾ ਫੀਸ ਸਟੱਕਚਰ ਸਾਰਾ ਕੁਛ ਤੁਹਾਨੂੰ ਮੈਂ ਦੱਸਿਆ ਕਿ ਵਧੀਆ ਆ ਪ੍ਰੋਫੈਸਰਸ ਵੀ ਸਾਰੇ ਵਧੀਆ ਹੈ ਨਾ ਅਤੇ ਤੁਹਾਨੂੰ ਜੋ ਸਿਲੇਬਸ ਆ ਉਹ ਬੁੱਕਸ ਵੀ ਪ੍ਰੋਵਾਈਡ ਕਰਵਾਉਂਦੇ ਆ ਪੜ੍ਹਨ ਦੇ ਲਈ ਮਟੀਰੀਅਲ ਵੀ ਪ੍ਰੋਵਾਈਡ ਕਰਦੇ ਆ ਅਤੇ ਸਭ ਕੁਛ ਵਧੀਆ ਹੈ ਮਤਲਬ ਵਧੀਆ ਯੂਨੀਵਰਸਿਟੀ ਹੈ ਨਹੀਂ ਟਰੇਨਿੰਗਸ ਵੀ ਦਿੰਦੇ ਹੈ ਹਾਂਜੀ ਤੁਸੀਂ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਯੂਨੀਵਰਸਿਟੀ ਅਤੇ ਆਪਣੀ ਐਡਮਿਸ਼ਨ ਕਰਵਾਓ ਅੱਛੀ ਯੂਨੀਵਰਸਿਟੀ ਹੈ ਹਾਂਜੀ ਓਕੇ ਵੇਲਕਮ